ਮੈਨੂੰ ਭੱਜਣ ਦਾ ਬਹੁਤ ਸ਼ੌਕ ਹੈ ਜਿਸ ਲਈ ਮੈਂ ਰੋਜ਼ ਦਸ ਤੋਂ ਪੰਦਰਾਂ ਕਿਲੋਮੀਟਰ ਡੇਲੀ ਭੱਜਦਾ ਹਾਂ ਮੈਂ ਡੇਲੀ ਸਵੇਰੇ ਪੰਜ ਵਜੇ ਉੱਠਦਾ ਹਾਂ ਅਤੇ ਆਪਣੇ ਆਪ ਨੂੰ ਤਿਆਰ ਕਰਕੇ ਚੰਗੀ ਐਕਸਰਸਾਈਜ਼ ਕਰਕੇ ਮੈਂ ਭੱਜਣ ਲਈ ਨਿਕਲ ਜਾਂਦਾ ਹਾਂ ਮੇਰੇ ਘਰ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੂਰੀ 'ਤੇ ਇੱਕ ਵਧੀਆ ਸਟੇਡੀਅਮ ਹੈ ਜਿਸ ਵਿੱਚ ਪੂਰੇ ਜ਼ਿਲ੍ਹੇ ਜਾਂ ਪੂਰੇ ਸ਼ਹਿਰ ਦੇ ਲੋਕ ਸਵੇਰੇ ਆਉਂਦੇ ਹਨ ਅਤੇ ਆਪਣੀ ਐਕਸਰਸਾਈਜ਼ਾਂ ਕਰਦੇ ਹਨ ਅਤੇ ਭੱਜਦੇ ਹਨ ਭੱਜਣ ਦੀ ਲਈ ਮੈਂ ਇੱਕ ਵਧੀਆ ਡਾਇਟ ਵੀ ਫੋਲੋ ਕਰਦਾ ਹਾਂ ਜਿਸ ਵਿੱਚ ਚੰਗਾ ਖਾਣ ਪਾਣ ਅਤੇ ਡਾਇਟ ਅਨੁਸਾਰ ਚਨੇ ਗੁੜ ਦੁੱਧ ਕੇਲੇ ਇਹਨਾਂ ਚੀਜ਼ਾਂ ਦਾ ਉਪਯੋਗ ਕਰਦਾ ਹਾਂ ਜਿਸ ਕਰਕੇ ਮੇਰੇ ਸਰੀਰ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਭੱਜਣ ਦੀ ਸ਼ਕਤੀ ਮਿਲਦੀ ਹੈ ਜਿਸ ਕਰਕੇ ਮੈਂ ਆਪਣੇ ਆਪ ਨੂੰ ਇੱਕ ਵਧੀਆ ਕੰਡੀਸ਼ਨ ਵਿੱਚ ਰੱਖ ਸਕਦਾ ਹਾਂ ਅਤੇ ਅੱਗੇ ਭੱਜਣ ਲਈ ਹੋਰ ਸ਼ਕਤੀ ਊਰਜਾ ਪ੍ਰਾਪਤ ਕਰ ਸਕਦਾ ਹਾਂ ਮੈਂ ਭੱਜਣ ਦੀ ਸਿੱਖਿਆ ਮਿਲਖਾ ਸਿੰਘ ਨੂੰ ਦੇਖ ਕੇ ਲਈ ਹੈ ਮੈਂ ਉਹਨਾਂ ਬਾਰੇ ਬਹੁਤ ਦੇਖਿਆ ਚਾਹੇ ਪੜ੍ਹਿਆ ਵੀ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਦੇਸ਼ ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਨਾਮ ਕਿਵੇਂ ਉੱਚਾ ਕੀਤਾ ਭੱਜ ਕੇ ਅਤੇ ਬਹੁਤ ਸਾਰੇ ਓਲੰਪਿਕ ਦੌੜਾਂ ਵਿੱਚ ਵੀ ਮੈਂ ਉਹਨਾਂ ਨੂੰ ਹੀ ਦੇਖ ਕੇ ਆਪਣੇ ਆਪ ਨੂੰ ਵੀ ਹਿੱਸਾ ਲਿੱਤਾ ਅਤੇ ਉਹਨਾਂ ਵਿੱਚ ਵੀ ਭੱਜਿਆ ਅਤੇ ਉਹਨਾਂ ਵਿੱਚ ਵੀ ਮੈਂ ਵਧੀਆ ਪ੍ਰਦਰਸ਼ਨ ਕੀਤਾ